ਹਾਂਜੀ ਡੋਕਟਰ ਸਾਹਿਬ ਡੋਕਟਰ ਸਾਹਿਬ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀਗੀ ਡਾਈਜਸ਼ਨ ਰਿਲੇਟਿਡ ਉਹਦੇ ਬਾਰੇ ਗੱਲ ਕਰਨੀ ਸੀ

ਹਾਂਜੀ ਦਿਨੇਸ਼ ਹਾਂਜੀ ਦਿਨੇਸ਼ ਗੁਪਤਾ ਬੋਲ ਰਿਹਾ ਜੀ ਮੇਰੀ ਏਜ ਫੋਟੀ ਵੱਨ ਈਅਰਸ ਆ ਜੀ ਮੇਰੀ ਹਾਈਟ ਜੀ ਫਾਈਵ ਫੀਟ ਏਟ ਇੰਚ ਹੈ ਜੀ ਅਤੇ ਵੇਟ ਨਾਈਟੀ ਕੇ ਜੀ ਹੋਏਗਾ ਐਕਚੁਲੀ ਮੈਂ ਕੋਈ ਵੀ ਚੀਜ਼ ਖਾ ਰਿਹਾ ਨਾ ਤਾਂ ਉਹ ਮੇਰੇ ਡਾਈਜਸਟ ਨਹੀਂ ਹੋ ਰਹੀ ਹੈਗੀ ਅਤੇ ਮੈਨੂੰ ਕੰਫਰਟੇਬਲ ਜਿਹਾ ਫੀਲ ਨਹੀਂ ਹੋ ਰਿਹਾ ਮੈਨੂੰ ਐਂ ਲੱਗ ਰਿਹਾ ਕਿ ਮੈਂ ਮਤਲਬ ਹੈਵੀ ਖਾ ਰਿਹਾ ਜਦਕਿ ਮੈਂ ਖਾਣਾ ਬਹੁਤ ਲਾਈਟ ਖਾ ਰਿਹਾ ਸਵੇਰੇ ਮੈਂ ਹਲਕਾ ਜਿਹਾ ਬਰੇਕਫਾਸਟ ਕਰਦਾ ਪਰ ਕਰਦਾ ਪੰਜਾਬੀ ਪਰੋਂਠਾ ਵਗੈਰਾ ਹੀ ਖਾਂਦਾ ਅਤੇ ਉਸ ਤੋਂ ਬਾਅਦ ਸਿੱਧਾ ਲੰਚ ਹੀ ਹੁੰਦਾ ਔਫਿਸ ਦੇ ਵਿੱਚ ਅਤੇ ਉਸ ਤੋਂ ਬਾਅਦ ਬਹੁਤ ਲਾਈਟ ਜਿਹੇ ਸਨੈਕਸ ਜਿਹੇ ਸਾਢੇ ਕੁ ਪੰਜ ਵਜੇ ਅਤੇ ਫਿਰ ਡਿਨਰ ਰਾਤ ਨੂੰ ਸਾਢੇ ਕੁ ਅੱਠ ਵਜੇ ਦੇ ਕਰੀਬ ਪਾਣੀ ਪੰਜ ਛੇ ਗਲਾਸ ਹੋ ਜਾਂਦੇ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਮੈਂ ਸਟਾਰਟਿੰਗ ਵਾਸਤੇ ਜਿਹੜਾ ਪਾਣੀ ਦੀ ਇਨਟੇਕ ਆ ਜੀ ਉਹਨੂੰ ਵਧਾ ਦਿੰਦਾ ਠੀਕ ਹੈ ਥੈਂਕ ਯੂ ਜੀ ਥੈਂਕ ਯੂ